ਇੱਕ ਵਾਰ ਦੀ ਗੱਲ ਹੈ ਕਿ ਸਾਡੇ ਸਕੂਲ ਵਿੱਚ ਸਿਲਾਈ ਕੰਪੀਟੀਸ਼ਨ ਹੋਇਆ ਅਤੇ ਉਸ ਕੰਪੀਟੀਸ਼ਨ ਵਿੱਚ ਮੈਂ ਵੀ ਹਿੱਸਾ ਲਿਆ ਪਰ ਉਸ ਸਮੇਂ ਤਿਆਰੀ ਕਰਨ ਦਾ ਮੌਕਾ ਵੀ ਨਹੀਂ ਮਿਲਿਆ ਪਰ ਫਿਰ ਵੀ ਮੈਂ ਸੂਟ ਡਿਜ਼ਾਈਨ ਕੀਤਾ ਅਤੇ ਅੰਦਰੋਂ ਮੈਨੂੰ ਬਹੁਤ ਡਰ ਸੀ ਫਿਰ ਵੀ ਉਹ ਸੂਟ ਸਾਰਿਆਂ ਨੇ ਬਹੁਤ ਹੀ ਪਸੰਦ ਕੀਤਾ ਅਤੇ ਮਾਣ ਵਾਲੀ ਗੱਲ ਇਹ ਹੋਈ ਕਿ ਮੈਨੂੰ ਉਨ੍ਹਾਂ ਨੇ ਜਦੋਂ ਸਟੇਜ 'ਤੇ ਬੁਲਾਇਆ ਅਤੇ ਫਸਟ ਪ੍ਰਾਈਜ ਦਿੱਤਾ ਅਤੇ ਹੌਸਲਾ ਦਿੱਤਾ ਅਤੇ ਬਹੁਤ ਹੀ ਤਾਰੀਫਾਂ ਕੀਤੀਆਂ